ਪੰਜਾਬ ਦੇ ਵਿੱਚ ਬਹੁਤ ਸਾਰੇ ਸੰਗੀਤ ਅਤੇ ਨ੍ਰਿਤ ਹੈ ਜਿਹੜੇ ਤਿਉਹਾਰ ਹੈ ਉਹ ਵੱਡੇ ਦਰਸ਼ਕਾਂ ਨੂੰ ਆਕਰਸ਼ਿਤ ਕਰਦਾ ਹੈ ਜਿਵੇਂ ਭੰਗੜਾ ਭੰਗੜਾ ਜਿਹੜਾ ਪੰਜਾਬ ਦੀ ਜ਼ਿੰਦ ਜਾਨ ਹੈ ਇਸ ਤਰ੍ਹਾਂ ਗਿੱਧਾ ਜਿਹੜੀ ਵੀ ਸਟੇਜ ਦੇ ਉੱਤੇ ਭੰਗੜਾ ਅਤੇ ਗਿੱਧਾ ਨਹੀਂ ਪੈਂਦਾ ਤਾਂ ਉਹ ਸਟੇਜ ਨੂੰ ਆਪਾਂ ਸਾਹਿਤਕ ਜਿਹੜੀ ਸਟੇਜ ਹੈ ਉਹ ਨਹੀਂ ਕਹਿ ਸਕਦੇ ਕਿਉਂਕਿ ਭੰਗੜਾ ਅਤੇ ਗਿੱਧਾ ਪੰਜਾਬ ਦੇ ਲੋਕਾਂ ਦੀ ਪ੍ਰਮੁੱਖ ਸੰਗੀਤ ਦੇ ਵਿੱਚ ਆਉਂਦਾ ਹੈਗਾ ਤਾਂ ਨ੍ਰਿਤ ਦੇ ਵਿੱਚ ਆਉਂਦਾ ਹੈਗਾ ਉਸ ਤੋਂ ਬਿਨਾਂ ਅਸੀਂ ਕਿਆ ਸ ਹੀ ਨਹੀਂ ਕਰ ਸਕਦੇ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਕੋਈ ਪੰਜਾਬ ਦਾ ਮਤਲਬ ਸਾਹਿਤਕ ਪ੍ਰੋਗਰਾਮ ਹੋ ਰਿਹਾ ਜਿੱਥੇ ਭੰਗੜਾ ਅਤੇ ਗਿੱਧਾ ਨਾ ਹੋਵੇ ਅਤੇ ਇਸ ਤੋਂ ਬਿਨਾਂ ਬਹੁਤ ਸਾਰੀਆਂ ਜਿਹੜੀਆਂ ਕਵਾਲੀਆਂ ਬਹੁਤ ਵੱਡੇ ਵੱਡੇ ਧਾਰਮਿਕ ਪ੍ਰੋਗਰਾਮ ਇਹ ਹੁੰਦੇ ਜਿੱਥੇ ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਕਵਾਲੀਆਂ ਗਾਈਆਂ ਜਾਂਦੀਆਂ ਜਾਂ ਹੋਰ ਲੋਕ ਤੱਥ ਜਿੱਥੇ ਗਾਏ ਜਾਂਦੇ ਹੈ ਜਿੱਥੇ ਲੋਕਾਂ ਦੇ ਮੰਗਾਂ ਮਸਲਿਆਂ ਦੀ ਗੱਲ ਲੋਕਾਂ ਦੇ ਦੁੱਖਾਂ ਸੁੱਖਾਂ ਦੀ ਗੱਲ ਹੈ ਲੋਕਾਂ ਦੇ ਘਰਾਂ ਦੇ ਵਿੱਚ ਚੱਲਦੀਆਂ ਆਮ ਨੋਕ ਝੋਕ ਦੀ ਗੱਲ ਉਹ ਗੀਤ ਸੰਗੀਤ ਦੇ ਰਾਹੀਂ ਅਤੇ ਜਿਹੜੀ ਹੈ ਸਿੱਠਣੀਆਂ ਦੇ ਰਾਹੀਂ ਲੋਕ ਬੋਲੀਆਂ ਦੇ ਰਾਹੀਂ ਹੋਰ ਬਹੁਤ ਸਾਰੇ ਤਰੀਕਿਆਂ ਦੇ ਰਾਹੀਂ ਉਹ ਲੋਕਾਂ ਦੇ ਵਿੱਚ ਲਿਜਾਈ ਜਾਂਦੀ ਹੈ ਤਾਂ ਬਹੁਤ ਸਾਰੇ ਤਿਉਹਾਰ ਵੀ ਇਸ ਤਰ੍ਹਾਂ ਦੇ ਹੈਗੇ ਆ ਅਤੇ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਰਹਿੰਦੇ